ਮੈਨੂੰ ਮੇਰੇ ਇਲਾਕੇ ਵਿੱਚ ਹਸਪਤਾਲ਼ਾਂ ਦਾ ਕੋਈ ਵੀ ਮਾੜਾ ਅਨੁਭਵ ਮਹਿਸੂਸ ਨਹੀਂ ਹੋਇਆ ਕਿਉਂਕਿ ਮੇਰੇ ਖੇਤਰ ਦੇ ਜੋ ਹਸਪਤਾਲ ਹਨ ਉਹ ਬਹੁਤ ਹੀ ਜ਼ਿਆਦਾ ਵਧੀਆ ਹਨ